ਮੇਰਾ ਨਾਮ ਇੰਦਰਜੀਤ ਕੌਰ ਆ ਮੇਰੀ ਜਨਮ ਤਰੀਕ ਫਸਟ ਐਪ੍ਰਲ ਉੱਨੀ ਸੌ ਸੱਤਰ ਹੈ ਮੇਰੀ ਹਾਈਟ ਪੰਜ ਫੁੱਟ ਅੱਠ ਇੰਚ ਹੈ ਮੈਂ ਐੱਮ ਏ ਬੀ ਐੱਡ ਕੀਤੀ ਹੋਈ ਆ ਐਟ ਪ੍ਰੈਜੈਂਟ ਮੈਂ ਸਰਕਾਰੀ ਸਕੂਲ ਦੇ ਵਿੱਚ ਐਜ਼ ਏ ਹੈਡ ਟੀਚਰ ਕੰਮ ਕਰ ਰਹੀ ਹਾਂ ਮੇਰੀ ਸਟੱਡੀ ਚੰਡੀਗੜ੍ਹ ਅਤੇ ਜਲੰਧਰ ਵਿੱਚ ਹੋਈ ਹੈ ਅਤੇ ਮੇਰੇ ਵੱਡਾ ਬ੍ਰਦਰ ਉਹ ਸੀਨੀਅਰ ਜਨਰਲ ਮੈਨੇਜਰ ਨੇ ਬੈਂਕ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਛੋਟਾ ਬ੍ਰਦਰ ਲੈਕਚਰਾਰ ਇੰਗਲਿਸ਼ ਮੇਰੇ ਮਦਰ ਵੀ ਸਰਕਾਰੀ ਜੋਬ ਕਰਦੇ ਸੀ ਉਹ ਵੀ ਹੈੱਡ ਟੀਚਰ ਹੀ ਰਿਟਾਇਰ ਹੋਏ ਸੀਗੇ ਫਾਦਰ ਮੇਰੇ ਏਅਰਫੋਰਸ ਵਿੱਚ ਸੀਗੇ ਮੇਰੀ ਦਾਦਕਿਆਂ ਦੀ ਫੈਮਿਲੀ ਦੇ ਵਿੱਚ ਮੇਰੇ ਦ ਮੇਰੇ ਫਾਦਰ ਅਤੇ ਮੇਰੇ ਇੱਕ ਚਾਚਾ ਜੀ ਅਤੇ ਮੇਰੇ ਤਾਇਆ ਜੀ ਇਹ ਤਿੰਨ ਏਅਰਫੋਰਸ ਵਿੱਚ ਸੀਗੇ ਫਾਦਰ ਐਸ ਕਮਾਂਡਰ ਰਿਟਾਇਰ ਹੋਏ ਸੀਗੇ ਮੇਰੇ ਹਸਬੈਂਡ ਐੱਲ ਆਈ ਸੀ ਵਿੱਚ ਡਿਵੈਲਪਮੈਂਟ ਆਫਿਸਰ ਸੀਗੇ ਔਰ ਮੇਰੇ ਸਹੁਰਾ ਸਾਹਿਬ ਵੀ ਉਹ ਵੀ ਆਰਮੀ ਵਿੱਚ ਸੀਗੇ ਸੋ ਸਾਡੀ ਸਾਰੀ ਫੈਮਿਲੀ ਹਾਈਲੀ ਐਜੂਕੇਟਿਡ ਹੈ ਅਤੇ ਧੰਨਵਾਦ ਜੀ